ਆਉਣ ਵਾਲੇ ਸਾਲਾਂ ਵਿੱਚ ਸਾਡੇ ਉਦਯੋਗ 'ਤੇ ਮੈਨੂੰ ਲੱਗਦਾ ਹੈ ਇੰਟਰਨੈੱਟ ਦਾ ਜ਼ਿਆਦਾ ਪ੍ਰਭਾਵ ਰਹੇਗਾ ਕਿਉਂਕਿ ਹੁਣ ਜਿਹੜਾ ਵੀ ਕੰਮ ਕਰਨਾ ਹੁੰਦਾ ਉਹ ਸਾਰਾ ਆਨਲਾਈਨ ਹੀ ਹੋ ਜਾਂਦਾ ਅਤੇ ਘਰ ਬੈਠੇ ਹੀ ਆਪਾਂ ਕਰ ਸਕਦੇ ਅਤੇ ਹੌਲੀ ਹੌਲੀ ਲੱਗਦਾ ਕਿ ਜਿੰਨੇ ਵੀ ਆਉਣ ਵਾਲੇ ਜਿੰਨੇ ਵੀ ਕੰਮ ਹੋਣਗੇ ਜਾਂ ਕੋਈ ਵੀ ਚੀਜ਼ ਹੋਏਗੀ ਉਹ ਆਪਾਂ ਔਨਲਾਈਨ ਹੀ ਕਰ ਸਕਣਗੇ ਪਰ ਇੱਦਾਂ ਇਸਦਾ ਇਹ ਵੀ ਆ ਕਿ ਆਉਣ ਵਾ ਵਾਲੀ ਜਨਰੇਸ਼ਨ ਜਾਂ ਹੋਰ ਹੀ ਜਨਰੇਸ਼ਨ ਸਾਰੇ ਹੀ ਕੀ ਏ ਇੰਟਰਨੈੱਟ 'ਤੇ ਡਿਪੈਂਡ ਹੋ ਜਾਣਗੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਇੰਟਰਨੈੱਟ 'ਤੇ ਡਿਪੈਂਡ ਹੋਏਗਾ ਅਤੇ ਹਰ ਕੰਮ ਆਪਣਾ ਆਨਲਾਈਨ ਹੀ ਕਰੇਗਾ ਜਿਵੇਂ ਕਿ ਹੁਣ ਸਕੂਲ ਅਤੇ ਕਾਲਜਾਂ ਵਿੱਚ ਵੀ ਪੜ੍ਹਾਈ ਆਨਲਾਈਨ ਹੀ ਹੋ ਰਹੀ ਹੈ ਅਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਇਹ ਪੜ੍ਹਾਈ ਬਿਲਕੁਲ ਹੀ ਆਨਲਾਈਨ ਹੋ ਜਾਵੇਗੀ ਜਿਸ ਨਾਲ ਟੀਚਰ ਜਾਂ ਕੋਈ ਵੀ ਵਿੱਚ ਕਿਸੇ ਦਾ ਵੀ ਰੋਲ ਨਹੀਂ ਰਹਿ ਜਾਏਗਾ ਜੋ ਵੀ ਰੋਲ ਹੋਏਗਾ ਆਨਲਾਈਨ ਕੋਆਡੀਨੇਟਰ ਦਾ ਹੀ ਰੋਲ ਹੋਏਗਾ ਅਤੇ ਬੱਚੇ ਬਜ਼ੁਰਗ ਸਾਰੇ ਹੀ ਹਰੇਕ ਕੰਮ ਲਈ ਇਸ 'ਤੇ ਡੀਪੈਂਡ ਹੋਣਗੇ ਅਤੇ ਇਸ ਦਾ ਇਹ ਵੀ ਹੈ ਕਿ ਹੌਲੀ ਹੌਲੀ ਲੋਕ ਇੱਕ ਦੂਜੇ ਨਾਲ ਮਿਲਣਾ ਵੀ ਘੱਟ ਕਰ ਦੇਣਗੇ ਜਿਸ ਨਾਲ ਕਿ ਹੈ ਕਿ ਸਾਰੇ ਹੀ ਆਨਲਾਇਨ ਹੀ ਇੱਕ ਦੂਜੇ ਨਾਲ ਗੱਲ ਕਰਨ ਲੈਂਦੇ ਨੇ ਆਨਲਾਇਨ ਹੀ ਇੱਕ ਦੂਜੇ ਨੂੰ ਵੇਖ ਲੈਂਦੇ ਨੇ ਹੌਲੀ ਹੌਲੀ ਇੱਕ ਦੂਜੇ ਨਾਲ ਮੇਲ ਮਿਲਾਪ ਵੀ ਘਟਦਾ ਜਾਏਗਾ ਅਤੇ ਹਰ ਕੋਈ ਆਪਣੇ ਆਪਣੇ ਘਰ ਬੈਠਾ ਹੀ ਫੋਨ 'ਤੇ ਜੋ ਚਾਹੇ ਉਹ ਕਰ ਸਕੇਗਾ ਇੰਟਰਨੈੱਟ ਇੱਕ ਅਜਿਹਾ ਹਿੱਸਾ ਬਣ ਜੇਗਾ ਜਿਹਨੂੰ ਆਪਾਂ ਭੁੱਲ ਵੀ ਨਹੀਂ ਸਕਾਂਗੇ ਅਤੇ ਇੰਟਰਨੈੱਟ ਨਾਲ ਹੀ ਆਪਾਂ ਅੱਗੇ ਅੱਗੇ ਆਪਣੇ ਆਪ ਨੂੰ ਲੈ ਕੇ ਜਾਵਾਂਗੇ ਇਹ ਇਸਦੇ ਕੁਝ ਸਾਇਡ ਇਫੇਕਟ ਵੀ ਹਨ ਕਿਉਂਕਿ ਇਹ ਆਉਣ ਵਾਲੀ ਆਪਣੀ ਜਨਰੇਸ਼ਨ ਲਈ ਸਿਰਫ਼ ਇੱਕ ਫੋਨ ਹੀ ਰਹਿ ਜੇਗਾ ਜਿਸ ਉੱਤੇ ਉਹ ਡੀਪੈਂਡ ਹੋਏਗਾ ਬੱਚੇ ਤੋਂ ਲੈ ਕੇ ਹਰੇਕ 'ਚ ਕਿਸੇ ਨੂੰ ਫੋਨ ਦਾ ਹੀ ਰਹੇਗਾ ਪਰ ਮੇਰੇ ਲਈ ਇਹ ਹੈ ਕਿ ਆਪਾਂ ਨੂੰ ਇੰਟਰਨੈੱਟ ਨੂੰ ਜਿੰਨੇ ਆਪਾਂ ਘੱਟ ਲੋੜ ਪਏ 'ਤੇ ਹੀ ਵਰਤੋਂ ਕਰ ਸਕਦੇ ਹਾਂ ਉਨ੍ਹੀਂ ਹੀ ਕਰੀਏ ਜ਼ਿਆਦਾ ਨਾ ਕਰੀਏ ਪਰ ਐਂ ਹਾਂ ਕਿ ਆਉਣ ਵਾਲੇ ਸਾਲਾਂ ਵਿੱਚ ਆਪਾਂ ਇਸ 'ਤੇ ਇੰਨੇ ਜ਼ਿਆਦਾ ਡੀਪੈਂਡ ਹੋ ਜਾਣਗੇ ਕਿ ਆਪਾਂ ਇਸ ਨੂੰ ਆਪਣੇ ਜ਼ਿੰਦਗੀ ਵਿਚੋਂ ਕੱਢ ਨਹੀਂ ਸਕਣਗੇ ਅਤੇ ਆਪਣਾ ਸਾਰੀ ਲਾਇਫ਼ ਕੀ ਏ ਕਿ ਇੰਟਰਨੈੱਟ 'ਤੇ ਹੀ ਡੀਪੈਂਡ ਰਹਿ ਜੇਗੀ